ਇਸ ਵਿੱਚ ਮੈਨੂੰ ਪੁੱਛਿਆ ਗਿਆ ਹੈ ਕਿ ਤੁਸੀਂ ਉਸ ਸਮੇਂ ਦੀ ਉਦਾਹਰਣ ਸਾਂਝੀ ਕਰੋ ਜਦੋਂ ਤੁਸੀਂ ਖ਼ਬਰਾਂ ਦੀ ਕਵਰੇਜ ਵਿੱਚ ਸੰਨਸਨੀ ਖੇਜ ਜਾਂ ਕਲਿੱਕਵਾਡ ਦੀਆਂ ਚਾਲਾਂ ਦੀ ਵਰਤੋਂ ਕੀਤੀ ਸੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਹੁਤ ਤਰ੍ਹਾਂ ਦੀਆਂ ਖ਼ਬਰਾਂ ਲਗਾਈਆਂ ਹਨ ਅਤੇ ਬਹੁਤ ਤਰ੍ਹਾਂ ਦੀ ਖ਼ਬਰਾਂ ਦਾ ਕਵਰੇਜ ਵੀ ਕੀਤਾ ਹੈ ਜਿਸ ਵਿੱਚ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਮਿਲੀਆਂ ਅਤੇ ਉਹ ਖ਼ਬਰਾਂ ਮੈਂ ਆਪਣੇ ਵੱਲੋਂ ਪੂਰੇ ਸਹੀ ਤਰੀਕੇ ਨਾਲ ਛਾਪੀਆਂ ਤਾਂ ਜੋ ਲੋਕਾਂ ਵਿੱਚ ਇਸਦੀ ਸਹੀ ਜਾਣਕਾਰੀ ਜਾ ਸਕੇ ਖ਼ਬਰਾਂ ਨਾ ਛਾਪਣ ਲਈ ਵੀ ਮੈਨੂੰ ਕਈਆਂ ਨੇ ਵਿਰੋਧ ਕੀਤਾ ਪਰ ਮੈਂ ਕਿਸੇ ਦੀ ਨਹੀਂ ਸੁਣੀ ਮੈਂ ਸਿਰਫ਼ ਆਪਣੇ ਕੰਮ ਵੱਲ ਧਿਆਨ ਦਿੱਤਾ ਅਤੇ ਸਾਰੀਆਂ ਖ਼ਬਰਾਂ ਨੂੰ ਸਹੀ ਤਰੀਕੇ ਨਾਲ ਛਾਪਿਆ ਅਤੇ ਲੋਕਾਂ ਦੇ ਰੁ ਬ ਰੁ ਕੀਤਾ ਮੇਰੀਆਂ ਖ਼ਬਰਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਨ ਮੇਰੇ ਸਥਾਨਕ ਲੋਕਾਂ ਲਈ ਤਾਂ ਜੋ ਮੇਰੀ ਏਰੀਏ ਵਿੱਚ ਜੇਕਰ ਕੋਈ ਵੀ ਗਲਤ ਕੰਮ ਹੁੰਦਾ ਹੈ ਮੈਂ ਉਹਨਾਂ ਖ਼ਬਰਾਂ ਨੂੰ ਲੋਕਾਂ ਤੱਕ ਪਹੁੰਚਾਵਾਂ ਉੱਚੇ ਅਫ਼ਸਰਾਂ ਤੱਕ ਪਹੁੰਚਾਵਾਂ ਤਾਂ ਜੋ ਉਹ ਇਹ ਖ਼ਬਰ ਦੇਖ ਕੇ ਜਾਂ ਸੁਣ ਕੇ ਇਸ ਦੇ ਵਿਰੁੱਧ ਕੋਈ ਵੀ ਬਣਦੀ ਕਾਰਵਾਈ ਕਰ ਸਕਣ ਇਸ ਕੰਮ ਨਾਲ ਮੈਨੂੰ ਆਪਣੇ ਆਪ ਵਿੱਚ ਬਹੁਤ ਸੰਤੁਸ਼ਟੀ ਮਿਲੀ ਅਤੇ ਮੇਰਾ ਹੌਂਸਲਾ ਵੀ ਬਹੁਤ ਜ਼ਿਆਦਾ ਵਧਿਆ ਤਾਂ ਜੋ ਸਾਰੇ ਕੰਮ ਆਪਣੇ ਤਰੀਕੇ ਨਾਲ ਵਧੀਆ ਸਹੀ ਢੰਗ ਨਾਲ ਕੀਤੇ